ਇਹ ਗੱਲ ਸੱਚ ਹੈ ਕਿ ਭਾਰਤ ਵਿੱਚ ਕਲਾਕਾਰਾਂ ਨੂੰ ਲੋੜੀਂਦਾ ਮਹੱਤਵ ਅਤੇ ਮੌਕੇ ਨਹੀਂ ਦਿੰਦੇ ਦਿੱਤੇ ਜਾਂਦੇ ਹੈਗੇ ਜੋ ਵੀ ਜਿਸ ਫੀਲਡ ਦੇ ਵਿੱਚ ਹੈ ਸਿਰਫ ਉਹਨਾਂ ਨੂੰ ਹੀ ਆਪਣੇ ਜੋ ਅੱਗੇ ਉਹਨਾਂ ਦੇ ਪਾਪੂਲਰ ਜਾਂ ਫਿਰ ਵੱਡੇ ਆਰਟਿਸਟ ਹੁੰਦੇ ਨੇ ਉਹਨਾਂ ਨੂੰ ਹੀ ਉਹਨਾਂ ਬਾਰੇ ਪਤਾ ਹੁੰਦਾ ਆ ਹੋਰ ਕਿਸੇ ਨੂੰ ਨਹੀਂ ਪਤਾ ਹੁੰਦਾ ਜਿਸ ਕਰਕੇ ਜੋ ਉਹਨਾਂ ਦੀ ਕਲਾ ਹੈਗੀ ਲੋਕਾਂ ਤੋਂ ਮਤਲਬ ਛੁਪੀ ਹੋਈ ਰਹਿ ਜਾਂਦੀ ਹੈਗੀ ਲੋਕਾਂ ਦੇ ਸਾਹਮਣੇ ਨਹੀਂ ਆ ਪਾਉਂਦੀ ਹੈਗੀ ਹੈਗੀ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਉਹਨਾਂ ਦੀ ਕਲਾ ਨੂੰ ਐਪਰੀਸ਼ੀਏਟ ਕਰੀਏ ਉਹਨਾਂ ਨੂੰ ਬੜਾਵਾ ਦਈਏ ਤਾਂ ਜੋ ਆਪੋ ਉਹ ਆਪਣੇ ਦੇਸ਼ ਦੇ ਲਈ ਜਾਂ ਹੋਰ ਜ਼ਿਆਦਾ ਮਤਲਬ ਵਧੀਆ ਕਰ ਸਕਣ ਅਤੇ ਆਪਣੇ ਈਵਨ ਕੰਟਰੀ ਦਾ ਨਾਮ ਆ ਜੋ ਉਹ ਹੋਰ ਜ਼ਿਆਦਾ ਰੋਸ਼ਨ ਕਰਨ ਆਪਾਂ ਨੂੰ ਹਮੇਸ਼ਾ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ ਈਵਨ ਹਰ ਕਿਸੇ ਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਆ ਚਾਹੇ ਉਹ ਇਸ ਫੀਲਡ ਦੇ ਵਿੱਚ ਹੈ ਜਾਂ ਨਹੀਂ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਐਕਸਟਰਾ ਇਨਫੋਰਮੇਸ਼ਨ ਲੈਣੀ ਪਸੰਦ ਨਹੀਂ ਕਰਦਾ ਹੈਗਾ ਜੋ ਜਿਸ ਫੀਲਡ ਦੇ ਵਿੱਚ ਆ ਉਹ ਉਸ ਫੀਲਡ ਬਾਰੇ ਹੀ ਜਾਣਕਾਰੀ ਰੱਖਦਾ ਆ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਕਲਾਕਾਰਾਂ ਨੂੰ ਬਹੁਤ ਮਹੱਤਵ ਦਈਏ ਅਤੇ ਉਹਨਾਂ ਨੂੰ ਐਪਰੀਸ਼ੀਏਟ ਕਰੀਏ